ਆਵਾਜਾਈ ਦੀਆਂ ਸਹੂਲਤਾਂ ਦੀ ਘਾਟ ਸਿਹਤ ਸੰਭਾਲ 'ਤੇ ਪਹੁੰਚਣ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ ਕਿਉਂਕਿ ਆਵਾਜਾਈ ਵਿੱਚ ਐਂਬੂਲੈਂਸਾਂ ਸਾਡੇ ਖੇਤਰ ਵਿੱਚ ਬਹੁਤ ਹੀ ਜ਼ਿਆਦਾ ਘੱਟ ਹਨ ਅਤੇ ਜਿਸ ਕਾਰਣ ਹਸਪਤਾਲਾਂ ਵਿੱਚ ਮਰੀਜ਼ ਨਹੀਂ ਜਾ ਸਕਦੇ ਬਹੁਤ ਹੀ ਜ਼ਿਆਦਾ ਟਾਈਮ ਲੱਗ ਜਾਂਦਾ ਉਹਨਾਂ ਨੂੰ ਜਾਂਦਿਆਂ ਨੂੰ ਅਤੇ ਹਸਪਤਾਲ ਵੀ ਸਾਡੇ ਸ਼ਹਿਰਾਂ ਵਿੱਚ ਮਤਲਬ ਕਿ ਬਾਹਰਲੀ ਸਾਈਡ ਹੁੰਦੇ ਨੇ ਜਿਸ ਵਿੱਚ ਸਾਨੂੰ ਬੱਸ 'ਤੇ ਜਾਂਦੇ ਹੋਏ ਪਹਿਲਾਂ ਬੱਸ 'ਤੇ ਜਾਣਾ ਪੈਂਦਾ ਫਿਰ ਉੱਥੋਂ ਆਟੋ ਕਰਾਉਣਾ ਪੈਂਦਾ ਕਈ ਹਸਪਤਾਲ ਹੈਗੇ ਵੀ ਅਜੇ ਉਹ ਸ਼ਹਿਰ ਦੇ ਵਿੱਚ ਆ ਅਤੇ ਕਈਆਂ ਦੇ ਉੱਥੇ ਇਲਾਜ ਨਹੀਂ ਹੁੰਦੇ ਇਸ ਲਈ ਬਾਹਰਲੇ ਹੋਸਪੀਟਲ ਪਰ ਜਾਣਾ ਪੈਂਦਾ ਅਤੇ ਉੱਥੇ ਜਾਣ ਲਈ ਬਹੁਤ ਹੀ ਜ਼ਿਆਦਾ ਸਮਾਂ ਲੱਗਦਾ ਹੈਗਾ ਅਤੇ ਇਸ ਜੇਕਰ ਐਬੂਲੈਂਸਾਂ ਜ਼ਿਆਦਾ ਹੋਣ ਤਾਂ ਮਰੀਜ਼ ਜਲਦੀ ਪਹੁੰਚ ਜਾਣ ਪਹੁੰਚ ਜਾਣ ਅਤੇ ਸਮਾਂ ਵੀ ਘੱਟ ਲੱਗੇ ਅਤੇ ਜ਼ ਜਾਂ ਫਿਰ ਬੱਸਾਂ ਮਤਲਬ ਕੇ ਹਸਪਤਾਲਾਂ ਦੇ ਵ ਕੋਲ ਹੀ ਜਾਵਣ ਕਰਨ ਫਿਰ ਵੀ ਸਮਾਂ ਘੱਟ ਲੱਗੇ ਅਤੇ ਮਰੀਜ਼ ਵੀ ਜਲਦੀ ਪਹੁੰਚ ਜਾਣ ਤਾਂ ਜੇ ਕਰ ਸਮਾਂ ਜ਼ਿਆਦਾ ਲੱਗਦਾ ਅਤੇ ਮਰੀਜ਼ਾਂ ਮਰੀਜ਼ ਵੀ ਲੋਕ ਲੋਕ ਵੀ ਨੂੰ ਵੀ ਸਮਾਂ ਬਹੁਤ ਜ਼ਿਆਦਾ ਲੱਗ ਗਿਆ ਅਤੇ ਇਸ ਲਈ ਉਹ ਪਹੁੰਚ ਨਹੀਂ ਸਕਦੇ ਅਤੇ ਕਈ ਬਿਮਾਰੀਆਂ ਹੋਰ ਵੀ ਵੱਧ ਜਾਂਦੀਆਂ ਨੇ ਜੇਕਰ ਉਹ ਜਲਦੀ ਨਾ ਪਹੁੰਚਣ ਇਸ ਲਈ ਇਹ ਹੀ ਚਾਹੁੰਦੀ ਹਾਂ ਕਿ ਜਾਂ ਤਾਂ ਐਬੂਲੈਂਸਾਂ ਜ਼ਿਆਦਾ ਹੋ ਜਾਣ ਆਵਾਜਾਈ ਜਿਆਦਾ ਹੋ ਜੇ ਅਤੇ ਜਾਂ ਫਿਰ ਬੱਸਾਂ ਸਿੱਧੀਆਂ ਹੋਸਪੀਟਲ ਕੋਲ ਪਹੁੰਚ ਜਾਇਆ ਕਰਨ ਅਤੇ ਮਰੀਜ਼ਾਂ ਦੀਆਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਘੱਟ ਜਾਣ